ਸਤਿ ਸ਼੍ਰੀ ਅਕਾਲ ਜੀ ਐਮਾਜ਼ਾਨ ਤੋਂ ਬੋਲਦੇ ਜੀ ਮੈਂ ਤੁਹਾਡੇ ਤੋਂ ਇੱਕ ਟੀ ਸ਼ਰਟ ਔਰਡਰ ਕੀਤੀ ਤੀ ਜੀ ਜਦੋਂ ਉਹ ਮੇਰੇ ਕੋਲ ਪਹੁੰਚੀ ਤਾਂ ਉਹਦੀ ਪੈਕਿੰਗ ਫਟੀ ਹੋਈ ਤੀ ਖ਼ਰਾਬ ਹੋਈ ਵੀ ਤੀ ਜਦੋਂ ਉਸਨੂੰ ਮੈਂ ਖੋਲ੍ਹ ਕੇ ਦੇਖਿਆ ਜੋ ਕਲਰ ਮੈਂ ਔਰਡਰ ਕੀਤਾ ਤਾ ਉਹ ਕਲਰ ਸੇਮ ਨਹੀਂ ਤਾ ਅਤੇ ਉਹ ਜਦੋਂ ਮੈਂ ਪਾ ਕੇ ਦੇਖੀ ਤਾਂ ਓਹ ਓਵਰ ਸਾਈਜ਼ ਤਾ ਮੈਂ ਐਕਸ ਐੱਲ ਔਰਡਰ ਕੀਤਾ ਤਾ ਓਹ ਟ੍ਰਿਪਲ ਐਕਸ ਐੱਲ ਤੀ ਅੱਗੇ ਤੋਂ ਜ ਮੈਂ ਜਦੋਂ ਬਾਹਰ ਓ ਓਹਦਾ ਬਜ਼ਾਰ ਵਿੱਚ ਰੇਟ ਪਤਾ ਕੀਤਾ ਤਾਂ ਉਸ ਨਾਲੋਂ ਦੌਗੁਣਾ ਰੇਟ ਤਾਂ ਪਾਇਆ ਹੋਇਆ ਤਾ ਤੁਸੀਂ ਮ ਲਾਇਆ ਮੈਨੂੰ ਇਸ ਲਈ ਮੈਂ ਅੱਗੇ ਤੋਂ ਤੁਹਾਡੀ ਸਰਵਿਸ ਤੋਂ ਨਾ ਖੁਸ਼ ਹਾਂ ਮੈਂ ਅੱਗੇ ਤੋਂ ਤੁਹਾਡੇ ਕੋਲ ਅੱਗੇ ਤੋਂ ਤੁਹਾਡੇ ਐਪ ਰਾਹੀਂ ਕੋਈ ਵੀ ਆ ਕੋਈ ਆਈਟਮ ਨਹੀਂ ਮ ਔਰਡਰ ਕਰੂੰਗਾ ਜੀ